ਸਾਡੇ ਮੋਹਾਲੀ ਜ਼ਿਲ੍ਹੇ ਵਿੱਚ ਅਵਸਰ ਸਿਲਾਈ ਕੇਂਦਰ ਮੌਜੂਦ ਹਨ ਇੱਥੇ ਔਰਤਾਂ ਨੂੰ ਆਪਣਾ ਲੜਕੀਆਂ ਨੂੰ ਕੰਮ ਕਰਨ ਲਈ ਸਿਲਾਈ ਕਢਾਈ ਦੇ ਸੈਂਟਰ ਖੋਲ੍ਹੇ ਹੋੇਏ ਹਨ ਇੱਥੇ ਔਰਤਾਂ ਆਪਣਾ ਕੰਮ ਕਰਕੇ ਘਰ ਦਾ ਗੁਜ਼ਾਰਾ ਕਰ ਸਕਦੀਆਂ ਹਨ ਸਾਡੇ ਮੋਹਾਲੀ ਜ਼ਿਲ੍ਹੇ ਵਿੱਚ ਜੇ ਕਿਸੇ ਕਿਸੇ ਨੇ ਕੋਈ ਪੇਪਰ ਦੇਣਾ ਹੋਵੇ ਉਸ ਦੇ ਵਾਸਤੇ ਕੋਚਿੰਗ ਸੈਂਟਰ ਖੋਲ੍ਹੇ ਹੋਏ ਹਨ ਸਾਡੇ ਮੋਹਾਲੀ ਜ਼ਿਲ੍ਹੇ ਵਿੱਚ ਖੇਡ ਆਪਣਾ ਖੇਡਣ ਕ੍ਰਿਕਟ ਸਟੇਡੀਅਮ ਖੇਡਣ ਲਈ ਕ੍ਰਿਕਟ ਸਟੇਡੀਅਮ ਬਹੁਤ ਵਧੀਆ ਹੈ ਅਤੇ ਜਿੰਮਾਂ ਹੁਣ ਬਹੁਤ ਹਨ ਰੋਜ਼ਗਾਰ ਲਈ ਲੇਬਰ ਕਾਰਡ ਸਾਡੇ ਮੋਹਾਲੀ ਜ਼ਿਲ੍ਹੇ ਲੇਬਰ ਕਾਰਡ ਬਣੇ ਹੋਏ ਹਨ ਆਯੂਸ਼ਮਾਨ ਕਾਰਡ ਜਿਹਨਾਂ ਕਰਕੇ ਹੋਸਪਿਟਲ ਦਾ ਪੰਜ ਲੱਖ ਰੁਪਏ ਦਾ ਖਰਚਾ ਮਾਫ ਹੁੰਦਾ ਹੈ ਮਾਫ ਹੁੰਦਾ ਹੈ ਸਾਡੇ ਮੋਹਾਲੀ ਜ਼ਿਲ੍ਹੇ ਵਿੱਚ ਬਾਹਰ ਤੋਂ ਆ ਕੇ ਕੋਈ ਵੀ ਆਪਣਾ ਵਿਹਲਾ ਨਹੀਂ ਰਹਿ ਸਾਡੇ ਮੋਹਾਲੀ ਜ਼ਿਲ੍ਹੇ ਵਿੱਚ ਫੈਕਟਰੀਆਂ ਬਹੁਤ ਹਨ ਜਿੱਥੇ ਕੋਈ ਵੀ ਆਮ ਬੰਦਾ ਕੰਮ ਕਰ ਸਕਦਾ ਹੈ ਸਾਡਾ ਮੋਹਾਲੀ ਜ਼ਿਲ੍ਹਾ ਵਿੱਚ ਆਪਣਾ ਖੇਡਣ ਲਈ ਗਰਾਊਂਡ ਜਿੰਮ ਜਿੰਮਾਂ ਐਕਸਰਸਾਈਜ਼ ਕਰਨ ਲਈ ਜਿੰਮਾਂ ਅਤੇ ਹੋਰ ਵੀ ਸਰੀਰ ਨੂੰ ਫਿੱਟ ਰੱਖਣ ਲਈ ਯੋਗਾ ਕਰਨ ਲਈ ਕੇਂਦਰ ਖੋਲ੍ਹੇ ਹੋਏ ਹਨ